ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਜਿਹੜਾ ਮੁੱਖ ਸੱਭਿਆਚਾਰਕ ਅੰਤਰ ਹੈ ਉਹ ਖਾਣ ਪੀਣ ਦਾ ਹੈ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਅਤੇ ਰਹਿਣ ਸਹਿਣ ਦਾ ਹੈ ਜਿਵੇਂ ਕਿ ਅਸੀਂ ਖਾਣ ਪੀਣ ਦੀ ਗੱਲ ਕਰੀਏ ਤਾਂ ਜਿਹੜੇ ਸ਼ਹਿਰੀ ਲੋਕ ਹੁੰਦੇ ਨੇ ਉਹ ਬਹੁਤੀਆਂ ਦੁੱਧ ਮੱਖਣੀਆਂ ਜਾਂ ਅਸਲੀ ਡਾਇਟ ਜਿਹੜੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਉਹ ਨਹੀਂ ਲੈਂਦੇ ਉਹ ਬਹੁਤ ਜ਼ਿਆਦਾ ਪਰਹੇਜ਼ ਕਰਦੇ ਨੇ ਉਹਨਾਂ ਨੂੰ ਬਿਮਾਰੀਆਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਅਤੇ ਉਹ ਇਸ ਕਰਕੇ ਵੀ ਹੁੰਦੀਆਂ ਨੇ ਕਿਉਂਕਿ ਜਿਹੜੇ ਸ਼ਹਿਰੀ ਲੋਕ ਨੇ ਉਹ ਇਹ ਚੀਜ਼ਾਂ ਡਾਇਜੈਸਟ ਨਹੀਂ ਕਰ ਪਾਉਂਦੇ ਜਿਹੜੇ ਪੇਂਡੂ ਲੋਕ ਹੁੰਦੇ ਨੇ ਉਹ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਮਸ਼ੀਨਾਂ ਦੀ ਹੈਲਪ ਨਾਲ ਨਹੀਂ ਕਰਦੇ ਜਿਵੇਂ ਹੁਣ ਨੋਰਮਲ ਗੈਸ ਬਾਲਣਾ ਹੀ ਕਹਿ ਲਉ ਕਿੱਥੇ ਉਹ ਲੱਕੜਾਂ ਤੋੜ ਕੇ ਫਿਰ ਉਸ ਤੋਂ ਬਾਅਦ ਬਾਲ ਕੇ ਫਿਰ ਰੋਟੀ ਪਕਾਉਂਦੇ ਨੇ ਹੈ ਨਾ ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਮਿੱਟੀ ਨਾਲ ਜੁੜੇ ਰਹਿੰਦੇ ਨੇ ਅਤੇ ਉਹਨਾਂ ਦਾ ਟਾਈਮ ਟੇਬਲ ਜਿਹੜਾ ਬਹੁਤ ਵਧੀਆ ਹੁੰਦਾ ਜਿਵੇਂ ਕਿ ਉਹ ਸਵੇਰੇ ਸਵੇਰੇ ਚਾਰ ਵਜੇ ਜਾਂ ਪੰਜ ਵਜੇ ਉੱਠ ਜਾਂਦੇ ਨੇ ਅਤੇ ਉਹ ਘੱਟੋ ਘੱਟ ਸੱਤ ਅੱਠ ਵਜੇ ਤੱਕ ਸ਼ਾਮ ਦੇ ਰੋਟੀ ਖਾ ਲੈਂਦੇ ਨੇ ਅਤੇ ਸਾਡੇ ਇੱਥੇ ਸ਼ਹਿਰੀਆਂ ਦਾ ਜਿਹੜਾ ਹਿਸਾਬ ਹੁੰਦਾ ਉਹ ਕਿਤੇ ਕਿਤੇ ਅਸੀਂ ਅੱਠ ਨੌ ਵਜੇ ਉੱਠਣਾ ਅਤੇ ਉਸ ਤੋਂ ਬਾਅਦ ਰਾਤੀ ਸੌਣ ਦਾ ਕੋਈ ਫਿਕਸ ਟਾਈਮ ਹੀ ਨਹੀਂ ਹੋਣਾ ਅਤੇ ਜਿਹੜੇ ਮੈਨੂੰ ਲੱਗਦਾ ਸ਼ਹਿਰੀ ਲੋਕ ਨੇ ਆਪਸ 'ਚ ਉਹਨਾਂ ਦਾ ਤਾਲੂਕਾਤ ਮਤਲਬ ਇੰਨਾ ਗੂੜਾ ਨਹੀਂ ਹੁੰਦਾ ਜਿੰਨਾ ਜਿਹੜੇ ਸੰਬੰਧ ਹੁੰਦੇ ਨੇ ਇੰਨੇ ਗੂੜੇ ਨਹੀਂ ਹੁੰਦੇ ਜਿੰਨੇ ਪੇਂਡੂ ਲੋਕਾਂ ਦੇ ਹੁੰਦੇ ਨੇ ਉਹ ਇਕੱਠੇ ਬਹਿੰਦੇ ਨੇ ਇਕੱਠੇ ਬਹਿ ਕੇ ਜਿਵੇਂ ਰੋਟੀ ਬਣਾਉਣੀ ਸਬਜ਼ੀ ਕੱਟਣੀ ਹੈ ਨਾ ਵਿਹੜੇ 'ਚ ਬਹਿ ਕੇ ਅਤੇ ਕਿਤੇ ਸ਼ਹਿਰੀ ਲੋਕ ਜਿਨ੍ਹਾਂ ਦੇ ਛੋਟੇ ਛੋਟੇ ਘਰ ਹੁੰਦੇ ਨੇ ਮੋਸਟਲੀ ਅਤੇ ਲੋਕ ਗਲੀਆਂ ਵਿੱਚ ਨਿਕਲਦੇ ਹੀ ਨਹੀਂ ਅੱਜ ਕੱਲ੍ਹ ਪਹਿਲਾਂ ਤਾਂ ਫਿਰ ਨਿਕਲਦੇ ਹੁੰਦੇ ਸੀ ਤਾਂ ਮੇਜਰ ਆਹੀ ਅੰਤਰ ਹੈ ਦੋਵਾਂ ਚੀਜ਼ਾਂ ਵਿੱਚ